ਹੈਲੋ ਵਧੀਆ ਵਧੀਆ ਤੁਸੀਂ ਦੱਸੋ ਕੀ ਹਾਲ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਹਾਂਜੀ ਉਹਨਾਂ ਨੇ ਬਹੁਤ ਜ਼ਿਆਦਾ ਆਪਣੀ ਪੰਜਾਬੀ ਇੰਡਸਟਰੀ ਨੂੰ ਪੰਜਾਬੀ ਭਾਸ਼ਾ ਨੂੰ ਵੀ ਬਹੁਤ ਜ਼ਿਆਦਾ ਉੱਪਰ ਲੈ ਕੇ ਗਏ ਆ ਜਿਵੇਂ

ਜੀ ਬਿਲਕੁਲ ਹਾਂਜੀ ਹਾਂਜੀ ਉਹਨਾਂ ਨੇ ਆਪਣੀ ਨਾਲ ਹੀ ਆਪਣੀ ਟਰਬਨ ਨੂੰ ਵੀ ਪ੍ਰਮੋਟ ਕੀਤਾ ਹੋਇਆ ਵਾ ਸਾਊਥ ਇੰਡੀਅਨ ਦੇ ਲੋਕ ਵੀ ਭਾਵੇਂ ਉਹਨਾਂ ਨੂੰ ਨਹੀਂ ਪੰਜਾਬੀ ਬੋਲਣੀ ਆਉਂਦੀ ਨਾ ਹੀ ਉਹਨਾਂ ਨੂੰ ਸਮਝ ਲੱਗਦੀ ਆ ਪਰ ਉਹ ਜ਼ਰੂਰ ਸਿੱਧੂ ਮੂਸੇਆਲੇ ਨੂੰ ਜਾਣਦੇ ਆ ਦਿਲਜੀਤ ਨੂੰ ਜਾਣਦੇ ਨੇ ਦੁਨੀਆਂ ਦੇ ਵਿੱਚ ਬਹੁਤ ਸਾਰੇ ਲੋਕ ਦਿਲਜੀਤ ਦਾ ਤਾਂ ਹੁਣ ਏਸ਼ੀਆ ਦੇ ਵਿੱਚ ਦਸ

ਜੀ ਜੀ ਬਿਲਕੁਲ ਹਾਂਜੀ ਹਾਂਜੀ ਹਾਂਜੀ ਜਿਵੇਂ ਦਲਜੀਤ ਦਾ ਵੀ ਹੁਣ ਤੀ ਪਹਿਲੀ ਦਸਾਂ ਦੇ ਵਿੱਚ ਨਾਮ ਆ ਚੁੱਕਾ ਵਾ ਏਸ਼ੀਆ ਦੇ ਵਿੱਚ ਸੁਪਰ ਸਟਾਰ ਦੇ ਵਿੱਚ ਤੀਸਰੇ ਨੰਬਰ 'ਤੇ ਇਹ ਬੜੀ ਮਾਣ ਵਾਲੀ ਗੱਲ ਆ ਕਿ ਆਪਾਂ ਕਿਤੇ ਵੀ ਜਾਈਏ ਅਤੇ ਆਪਣਾ ਪੱਗ ਤੋਂ ਹੀ ਉਹਨਾਂ ਦੀ ਪਹਿਚਾਣ ਕਰ ਦਿੰਦੇ ਕਿ ਹਾਂ ਇਹ ਪੰਜਾਬ ਤੋਂ ਹੈਗੇ ਨੇ ਦੋਨਾਂ ਦਾ ਨਾਮ ਵੀ ਲੈਂਦੇ ਨੇ ਜਿਹਨਾਂ ਨੇ ਆਪਣੀ ਪੰਜਾਬੀ ਨੂੰ ਪੰਜਾਬ ਨੂੰ ਬਹੁਤ ਜ਼ਿਆਦਾ ਪ੍ਰਮੋਟ ਕੀਤਾ ਵਾ ਹਾਂਜੀ ਓਕੇ